ਭਾਰਤ ਦੇ ਵਿੱਚ ਬਹੁਤ ਕਿਸ ਬਹੁਤ ਅੱਡ ਅੱਡ ਧਰਮਾਂ ਦੇ ਲੋਕ ਰਹਿੰਦੇ ਹਨ ਜਿਹੜੇ ਸਿੱਖ ਇਸਾਈ ਬੋਧੀ ਅਤੇ ਅੱਡ ਅੱਡ ਧਰਮਾਂ ਦੇ ਧਰਮਿਕ ਸਥਾਨ ਵੀ ਇੱਥੇ ਬਹੁਤ ਹਨ ਮੇਰਾ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਮੈਂ ਇੱਕ ਸਿੱਖ ਹਾਂ ਅਤੇ ਮੇਰੇ ਜ਼ਿਲ੍ਹੇ ਦੇ ਵਿੱਚ ਸਬ ਛੋਟੇ ਸਾਹਿਬਜ਼ਾਦੇ ਗੁਰੂ ਗੋ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਸ਼ਹੀਦੀ ਹੋਈ ਸੀ ਜਿਹੜੀ ਕਿ ਗਿਆਰਾਂ ਬਾਰ੍ਹਾਂ ਤੇਰ੍ਹਾਂ ਪੋਹ ਨੂੰ ਉਹਨਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਸਭਾ ਵੀ ਮਨਾਈ ਜਾਂਦੀ ਹੈ ਛੋਟੇ ਬੱਚਿਆਂ ਨੂੰ ਮੋਤੀ ਰਾਮ ਜਪ ਜਦੋਂ ਜਦੋਂ ਛੋਟੇ ਬੱਚੇ ਸੂਬਾ ਸਰਹਿੰਦ ਦੀ ਜੇਲ੍ਹ ਵਿੱਚ ਸਨ ਤਾਂ ਮੋਤੀ ਰਾਮ ਮਹਿਰਾ ਜੀ ਨੇ ਬਹੁਤ ਜ਼ਿਆਦਾ ਤਸਤ ਕਸ਼ਟ ਲੈ ਕੇ ਦੁੱਧ ਦੀ ਸੇਵਾ ਬੱਚਿਆਂ ਨੂੰ ਕੀਤੀ ਬਹੁਤ ਠੰਡ ਸੀ ਠੰਡੇ ਬੁਰਜ ਵਿੱਚ ਕੈਦ ਸਨ ਉਹਨਾਂ ਨੂੰ ਤੱਤਾ ਦੁੱਧ ਪਿਲਾਇਆ ਅਤੇ ਆਪਣੀ ਸਾਰਾ ਸੋਨਾ ਜੇਵਰਾਤ ਔਰ ਅਵ ਸਾਰੇ ਮੁਸਲਮਾਨ ਸਿਪਾਹੀਆਂ ਨੂੰ ਦੇ ਦਿੱਤੇ ਅਤੇ ਜਦੋਂ ਸ਼ਹੀਦੀ ਹੋਈ ਦੀਵਾਨ ਟੋਡਰ ਮੱਲ ਨੇ ਸ ਸੂਬਾ ਸਰਹਿੰਦ ਤੋਂ ਮੋਹਰਾਂ ਖੜ੍ਹੀਆਂ ਕਰਕੇ ਸਾਰੀ ਜਗ੍ਹਾ ਖਰੀਦੀ ਅਤੇ ਖੜ੍ਹਵੀਆਂ ਮੋਹਰਾਂ ਦੇ ਪੈਸੇ ਉਹਨਾਂ ਨੂੰ ਦਿੱਤੇ ਜਿਹੜੀ ਕਿ ਜਗ੍ਹਾ ਅੱਜ ਸਾਰੀ ਦੁਨੀਆਂ ਤੋਂ ਮਹਿੰਗੀ ਜਗ੍ਹਾ ਕਹਾਉਂਦੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਦੀ ਸ਼ਹੀਦੀ ਦਾ ਬਦਲਾ ਫਿਰ ਸੂਬਾ ਸਰਹਿੰਦ ਦਾ ਅੰਤ ਕਰਕੇ ਲਿਆ ਥੈਂਕ